ਸਾਡੇ ਰੋਜ਼ਾਨਾ ਜੀਵਨ ਵਿੱਚ ਕਾਫ਼ੀ ਤੈਕ ਟੈਕਨੋਲੋਜੀ ਅਤੇ ਇਸ ਇਸ ਦੀ ਵਰਤੋਂ ਹੁੰਦੀ ਹੈ ਅੱਜ ਕੱਲ੍ਹ ਤੈਕਨੋਲੋਜੀ ਅ ਸਾਡੇ ਜੀਵਨ ਦਾ ਇੱਕ ਅਟੁੱਟ ਹਿੱਸਾ ਬਣ ਚੁੱਕੀ ਹੈ ਅਸੀਂ ਜਦੋਂ ਵੀ ਸਵੇਰੇ ਉੱਠਦੇ ਹਾਂ ਜਾਂ ਕਿਸੇ ਵੀ ਤਰੀਕੇ ਦਾ ਕੋਈ ਕੰਮ ਕਰਦੇ ਹਾਂ ਆਪਾਂ ਮ ਮੋਬਾਈਲ ਦੀ ਵਰਤੋਂ ਜ਼ਰੂਰ ਕਰਦੇ ਹਾਂ ਇੰਟਰਨੈਟ ਟਰਾਂਸਪੋਰਟ ਜਾਂ ਘਰੇਲੂ ਉਪਕਰਣ ਅਤੇ ਡਿਜੀਟਲ ਭੁਗਤਾਨ ਇਹ ਸਭ ਟੈਕਨੋਲੋਜੀ ਦੇ ਹੀ ਹਿੱਸੇ ਹਨ ਅਤੇ ਇਸ ਸਭ ਟੈਕਨੋਲੋਜੀ ਦੇ ਨਾਲ ਹੀ ਸਾਡੀ ਜ਼ਿੰਦਗੀ ਆਸਾਨ ਅਤੇ ਤੇਜ਼ ਬਣੀ ਹੈ ਸਭ ਤੋਂ ਜ਼ਿਆਦਾ ਵ ਵਰਤੋਂ ਹੋਣ ਵਾਲੇ ਟੈਕਨੋਲੋਜੀ ਮੋਬਾਇਲ ਹੈ ਜੋ ਕਿ ਆਪਾਂ ਸਵੇਰੇ ਉੱਠਦੇ ਸਾਰ ਹੀ ਅ ਉਸ ਦੀ ਵਰਤੋਂ ਕਰਦੇ ਹਾਂ ਜਿੱਦਾਂ ਕਿ ਉਦਾਹਰਣ ਵੱਜੋਂ ਜੇ ਆਪਾਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਜਾਂ ਆਪਾਂ ਕੋਈ ਚੀਜ਼ ਬਾਰੇ ਪਤਾ ਲਗਾਉਣਾ ਚਾਹੁੰਦੇ ਹਾਂ ਅਪਸ ਆਪਾਂ ਸਭ ਤੋਂ ਜ਼ਿਆਦਾ ਅ ਮੋਬਾਇਲ ਦੀ ਵਰਤੋਂ ਕਰਦੇ ਹਾਂ ਮੋਬਾਈਲ ਅਤੇ ਇੰਟਰਨੈਟ ਹੀ ਹੈ ਜਿਸ ਦੀ ਵਰਤੋਂ ਸਾਡੇ ਰੋਜ਼ ਦੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਹੈ ਪਰ ਜੇਕਰ ਅ ਸਾਡੇ ਜ਼ਿੰਦਗੀ ਵਿੱਚ ਅ ਮੋਬਾਈਲ ਇੰਟਰਨੈਟ ਜਾਂ ਬਿਜਲੀ ਨਾ ਹੋਣ ਸੰਚਾਰ ਠੱਪ ਹੋ ਜਾਂਦਾ ਹੈ ਕੰਮ ਰੁਕ ਜਾਂਦੇ ਹਨ ਕਾਰੋਬਾਰ ਅਤੇ ਹਸਪਤਾਲ ਵਧੀਆ ਢੰਗ ਨਾਲ ਨਹੀਂ ਚੱਲ ਸਕਦੇ ਅਤੇ ਸਾਡਾ ਜੀਵਨ ਵੀ ਕਾਫੀ ਔਖਾ ਹੋ ਜਾਵੇਗਾ ਬਿਨਾਂ ਇਸ ਤੈਕਨੋਲੋਜੀ ਦੇ ਬਗੈਰ ਜੇਕਰ ਆਟੋਮੇਸ਼ਨ ਨਾ ਹੋਵੇ ਉਦਯੋਗ ਵਿਕਸਿਤ ਨਹੀਂ ਹੋ ਸਕਦੇ ਅਤੇ ਜ਼ਿੰਦਗੀ ਬਹੁਤ ਹੀ ਪਿੱਛੇ ਰਹਿ ਜਾਂਦੀ ਹੈ ਟੈਕਨੋਲੋਜੀ ਸਿਰਫ ਸੌਖੇਪਣ ਲਈ ਨਹੀਂ ਇਹ ਸਭ ਇੱਕ ਜ਼ਰੂਰਤ ਬਣ ਚੁੱਕੀ ਹੈ ਇਹ ਸਾਨੂੰ ਜੋੜਦੀ ਹੈ ਤਾਂ ਇਹ ਸਾਡਾ ਕੰਮ ਆਸਾਨ ਕਰਦੀ ਹੈ ਅਤੇ ਜੀਵਨ ਦੀ ਗੁਣਵੱਤਾ ਵਧਾਉਂਦੀ ਹੈ ਅਸੀਂ ਇਸ ਦੀ ਵਧੇਰੀ ਵਰਤੋਂ ਕਰਦੇ ਹਨ ਪਰ ਇਹ ਵੀ ਜ਼ਰੂਰੀ ਹੈ ਕਿ ਇਸ ਨੂੰ ਸਮਝਦਾਰੀ ਨਾਲ ਵਰਤੋਂ ਕੀਤੀ ਜਾਵੇ ਕਿਉਂਕਿ ਤਕਨੋਲੋਜੀ ਉੱਤੇ ਜ਼ਿਆਦਾ ਨਿਰਭਰਤਾ ਵੀ ਠੀਕ ਨਹੀਂ ਹੈ ਪਰ ਅੱਜ ਕੱਲ੍ਹ ਇਸ ਦੇ ਬਿਨਾਂ ਜੀਣਾ ਵੀ ਕਾਫ਼ੀ ਔਖਾ ਹੋ ਗਿਆ ਹੈ